ਹੈਲੋ ਸਤਿ ਸ਼੍ਰੀ ਅਕਾਲ ਮੈਂ ਡਿਜਾਇਨ ਦੇ ਪੈਟਰਨ ਦੀ ਗੱਲ ਕਰਾਂ ਅਤੇ ਕੱਪੜੇ ਬਣਾਉਣ ਦੇ ਪੈਟਰਨ ਦੀ ਗੱਲ ਕਰਾਂ ਅਗਰ ਮੈਂ ਸਲਾਈ ਕਰਦੀ ਹਾਂ ਕੋਈ ਕੋਟੀ ਬੁਣ ਰਹੀ ਹਾਂ ਕੋਈ ਪੇਂਟ ਕਰ ਰਹੀ ਹਾਂ ਤਾਂ ਮੈਂ ਉਹਦਾ ਕੋਈ ਡਿਜ਼ਾਈਨ ਸਲੈਕਟ ਕਰਨਾ ਪਹਿਲਾਂ ਮੈਂ ਉਸਦਾ ਕਲਰ ਦੇਖੂੰਗੀ ਫਿਰ ਉਹਦੇ ਵਿੱਚ ਕਿਹੜੇ ਕਿਹੜੇ ਰੰਗ ਉੱਠਣਗੇ ਜਿਵੇਂ ਪੇਂਟ ਕਰਨਾ ਜਾਂ ਮੈਂ ਕਢਾਈ ਕਰਨੀ ਹੈ ਫਿਰ ਉਹਦਾ ਮੈਂ ਨਾਪ ਲੈ ਕੇ ਉਹਦਾ ਡਿਜ਼ਾਇਨ ਪੈਟਰਨ ਚੁਣ ਕੇ ਫਿਰ ਮੈਂ ਉਹਨੂੰ ਕੱਪੜਾ ਰੱਖ ਕੇ ਵਿਛਾ ਕੇ ਉਹਦੇ ਉੱਤੇੇ ਇੱਕ ਵਾਈਟ ਪੇਪਰ ਆਉਂਦਾ ਉਹ 'ਤੇ ਡਿਜ਼ਾਇਨ ਕ ਕਰ ਕੇ ਅਤੇ ਉਹ 'ਤੇ ਮੈਂ ਮਿੱਟੀ ਦੇ ਤੇਲ ਨਾਲ ਉਹਨੂੰ ਛਾਪ ਲਊਂਗੀ ਅਤੇ ਇਸ ਦੇ ਵਿੱਚ ਜ਼ਿਆਦਾ ਮੇਰੀ ਮਦਦ ਹੈ ਜਿਹੜਾ ਆਨਲਾਈਨ ਸਿਸਟਮ ਮੈਂ ਕਹਿ ਸਕਦੀ ਹਾਂ ਵੀ ਮੈਂ ਆਨਲਾਈਨ ਜ਼ਿਆਦਾ ਦੇਖਦੀ ਹੈ ਹੁਣ ਆਨਲਾਈਨ ਜ਼ਿਆਦਾ ਸਿਸਟਮ ਹੋਣ ਕਰਨ ਜ਼ਿੰਦਗੀ ਜਿਹੜੀ ਹੈ ਜਿਹੜੀ ਉਹ ਸੌਖੀ ਵੀ ਹੋ ਗਈ ਹੈ ਕੱਪੜਿਆਂ ਨੂੰ ਵਧੀਆ ਸਫਾਈ ਵਧੀਆ ਇੱਕ ਪੈਟਨਰ ਮੋਰਨੀਆਂ ਵਾਲਾ ਜਿਵੇਂ ਮੋਰਨੀਆਂ ਦੀ ਕਢਾਈ ਅੱਜ ਕੱਲ੍ਹ ਜ਼ਿਆਦਾ ਚੱਲਦੀ ਹੈ ਫੁਲਕਾਰੀ ਦੀ ਚਲਦੀ ਹੈ ਪੇਂਟਿੰਗ ਚਲਦੀ ਹੈ ਮ ਮੋਰਨੀਆਂ ਵਾਲੀ ਪੇਂਟਿੰਗ ਚੱਲਦੀ ਹੈ ਗੁਲਾਬ ਫਲਾਵਰ ਹੋ ਜਾਂਦੇ ਆ ਉਹ ਚੱਲਦੇ ਹੈਗੇ ਅਤੇ ਜਦੋਂ ਵੀ ਅਸੀਂ ਇਹ ਤਿਆਰ ਕਰਦੇ ਹਾਂ ਤਾਂ ਸਾਡੇ ਗਾਹਕ ਆ ਜਿਹੜੇ ਖੁਸ਼ ਹੋ ਜਾਂਦੇ ਆ ਸਾਨੂੰ ਨਵੀਂ ਰਾਇ ਵੀ ਦੇ ਕੇ ਜਾਂਦੇ ਆ ਗਾਹਕ ਸਾਨੂੰ ਨਵੀਂ ਰੈਅ ਵੀ ਦਿੰਦਾ ਅਤੇ ਸਾਡਾ ਦੋਸਤ ਵੀ ਹੋ ਜਾਂਦਾ ਹੈ ਤੋ ਮੈਂ ਜ਼ਿਆਦਾ ਜਿਹੜੀ ਆਪਣੀ ਮਦਦ ਹੈ ਨਾ ਉਹ ਆਨਲਾਈਨ ਹੀ ਕਰਨੀ ਹੈ ਇਹ ਲੱਖ ਡੇਢ ਲੱਖ ਤੱਕ ਇੱਕ ਮਸ਼ੀਨ ਆਉਂਦੀ ਹੈ ਉਹਦੇ ਵਿੱਚ ਇੱਕ ਡਿਜ਼ਾਇਨ ਸਲੈਕਟ ਕਰੋ ਸੂਟ ਰੱਖੋ ਉਹ ਦਿਨ ਦੇ ਵਿੱਚ ਚਾਰ ਸੂਟ ਕੱਢ ਦਿੰਦੀ ਹੈ ਆਪੇ ਉਹਨੇ ਕਲਰ ਲੈਣਾ ਆਪੇ ਉਹਨੇ ਰੀਲ ਚੱਕਣੀ ਆਪੇ ਉਹਨੇ ਰੰਗ ਚੱਕਣਾ ਬਸ ਅਸੀਂ ਇੱਕ ਡਿਜ਼ਾਇਨ ਸਲੈਕਟ ਕਰਨਾ ਚਾ ਹੁੰਦਾ ਹੈ ਅਤੇ ਉਹ ਜਿਹੜਾ ਅਸੀਂ ਡਿਜ਼ਾਇਨ ਸਲੈਕਟ ਕਰਦੇ ਆ ਉਹ ਇੱਕ ਵਧੀਆ ਬਰੈਂਡ ਵੀ ਹੁੰਦਾ ਆਨਲਾਈਨ ਇੱਕ ਵਧੀਆ ਸਰੋਤ ਵੀ ਹੁੰਦਾ ਨਵੇਂ ਨਵੇਂ ਸ ਅਸੀਂ ਜਿਹੜੇ ਡਿਜਾਇਨਰ ਹੈ ਉਹ ਅੱਗੇ ਦਿੰਦੇ ਹੈਗੇ ਆ ਅਤੇ ਨਵੀਆਂ ਨਵੀਆਂ ਅਸੀਂ ਕਢਾਈਆਂ ਕਰਦੇ ਹਾਂ ਅਤੇ ਸਾਡੇ ਜਿਹੜੇ ਗਾਹਕ ਹੈ ਉਹ ਸਾਡੇ ਨਾਲ ਬਹੁਤ ਵਧੀਆ ਜੁੜੇ ਹੋਏ ਹੈ ਤਾਂ ਜਿਹੜਾ ਤਾਂ ਜਿਹੜਾ ਸਿਲਾਈ ਕਢਾਈ ਦਾ ਜਿਹੜਾ ਸਰੋਤ ਹੈ ਉਹ ਆਨਲਾਈਨ ਬਹੁਤ ਵਧੀਆ ਹੈ ਜੋ ਇੱਕ ਬ੍ਰੈਂਡ ਦਾ ਰੂਪ ਦਿੰਦਾ ਹੈ ਧੰਨ